ਮੈਂ ਪੰਜਾਬ ਦੇ ਮੋਹਾਲੀ ਖੇਤਰ ਦਾ ਰਹਿਣ ਵਾਲ਼ਾ ਹਾਂ ਜਿੱਥੋਂ ਤੱਕ ਇੱਥੇ ਦੇਖਿਆ ਜਾਵੇ ਤਾਂ ਕੁੜਤਾ ਪਜਾਮਾ ਸੂਟ ਸਲਵਾਰ ਫੁਲਕਾਰੀ ਜਿਆਦਾ ਹੀ ਲੋਕ ਪਾਉਂਦੇ ਹਨ ਅਤੇ ਇੱਥੇ ਦੇ ਜੋ ਬਣਾਉਂਦੇ ਨੇ ਬਹੁਤ ਵਧੀਆ ਐਕਸਪਰਟ ਨੇ ਬਣਾਉਣ 'ਚ ਜੋ ਕਿ ਸਾਨੂੰ ਵਧੀਆ ਲੱਗਦਾ ਹੈ